ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰੁਣ ਕੁਮਾਰ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿਣ ਵਾਲਾ ਹਾਂ ਅੱਜ ਜੇ ਅਸੀਂ ਗੱਲ ਕਰੀਏ ਕਿ ਸਮਾਰਟ ਫੋਨ ਨੇ ਸਾਡੀ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾਇਆ ਹੈ ਤਾਂ ਇਸ ਦੇ ਉੱਤਰ ਵਿੱਚ ਬਸ ਮੈਂ ਕਹਿ ਸਕਦਾ ਹਾਂ ਕਿ ਸਮਾਰਟ ਫੋਨ ਨੇ ਕਈ ਤਰੀਕਿਆਂ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਵੀ ਵੇਖ ਲਈਏ ਅਤੇ ਅਸੀਂ ਕਿਸੇ ਵੀ ਵੇਲੇ ਕਿਸੇ ਵੀ ਜਗ੍ਹਾ ਤੋਂ ਮੈਸੇਜ ਕੋਲ ਵੀਡੀਓ ਕਾਲ ਕਰ ਸਕਦੇ ਹਾਂ ਇੰਟਰਨੈਟ 'ਤੇ ਸਾਡੀ ਉਂਗਲਾਂ ਦੇ ਨਾਲ ਅਸੀਂ ਖਬਰਾਂ ਪੜ੍ਹਾਈ ਅਤੇ ਪੜ੍ਹਾਈ ਦਾ ਸਮਾਨ ਜਾਂ ਹੋਰ ਕੋਈ ਵੀ ਜਾਣਕਾਰੀ ਤੁਰੰਤ ਪ੍ਰਾਪਤ ਕਰ ਸਕਦੇ ਹਾਂ ਸਮਾਰਟ ਫੋਨ ਸਾਡੇ ਮਨੋਰੰਜਨ ਦਾ ਸਾਧਨ ਵੀ ਹਮੇਸ਼ਾ ਬਣਦਾ ਰਿਹਾ ਹੈ ਜਿਵੇਂ ਕਿ ਅਸੀਂ ਇਸ 'ਤੇ ਗੇਮ ਖੇਲ ਸਕਦੇ ਹਾਂ ਇਸ 'ਤੇ ਫਿਲਮਾਂ ਦੇਖ ਸਕਦੇ ਹਾਂ ਗਾਣੇ ਸੁਣ ਸਕਦੇ ਹਾਂ ਜਾਂ ਫਿਰ ਸੋਸ਼ਲ ਮੀਡੀਆ ਵਗੈਰਾ ਚਲਾ ਸਕਦੇ ਹਾਂ ਜਿਸ ਵਿੱਚ ਯੂਟੀਊਬ ਇੰਸਟਾਗ੍ਰਾਮ ਫੇਸਬੁੱਕ ਆਦਿ ਆਉਂਦਾ ਹੈ ਸਮਾਰਟ ਫੋਨ ਦੇ ਵਿੱਚ ਸਾਨੂੰ ਕਈ ਐਪ ਮਿਲਦੇ ਹਨ ਜਿੱਦਾਂ ਕਿ ਕੈਲੰਡਰ ਰੀਮਾਂਈਡਰ ਜਾਂ ਨੋਟਿਸ ਵਰਗੇ ਐਪਸ ਜੋ ਕਿ ਸਾਨੂੰ ਸਾਡੀ ਜ਼ਿੰਦਗੀ ਵਿੱਚ ਮਦਦ ਕਰਦੇ ਹਨ ਸਮਾਰਟ ਫੋਨ ਦੀ ਮਦਦ ਨਾਲ ਅਸੀਂ ਸ਼ੋਪਿੰਗ ਬੈਂਕਿੰਗ ਕਰਨ ਵਿੱਚ ਸਾਨੂੰ ਬਹੁਤ ਸਹੂਲਤ ਪ੍ਰਾਪਤ ਹੁੰਦੀ ਹੈ ਸਮਾਰਟ ਫੋਨ ਨੇ ਸਾਡੀ ਦੁਨੀਆਂ ਭਰ ਦੀ ਜਾਣਕਾਰੀ ਸਾਡੇ ਲਈ ਸੌਖੇ ਬਣਾਏ ਹਨ ਦੁਨੀਆਂ ਭਰ ਦੀ ਜਾਣਕਾਰੀ ਇਸ ਸੰਪਰਕ ਸਾਡੇ ਦੇਸ਼ ਨੇ ਸੌਖੇ ਕਰ ਦਿੱਤੇ ਹਨ ਸਮਾਰਟ ਫੋਨ ਨੇ ਸਾਡੇ ਜੀਵਨ ਨੂੰ ਕਈ ਤਰ੍ਹਾਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਵੀ ਮਹੱਤਵ ਹੈ ਕਿ ਅਸੀਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਕਿਉਂਕਿ ਜੇ ਅਸੀਂ ਟੈਕਨੋਲੋਜੀ ਦੀ ਸਹੀ ਵਰਤੋਂ ਕਰਾਂਗੇ ਤਾਂ ਹੀ ਸਾਡਾ ਜੀਵਨ ਸ ਕੁਸ਼ਲਮੰਦ ਰਹੇਗਾ ਧੰਨਵਾਦ